ਸਕਾਰ ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਮੈਂ ਗੱਲ ਕੀਤੀ ਕਿ ਮੈਨੂੰ ਲਿਖਣਾ ਬਹੁਤ ਪਸੰਦ ਹੈ ਲਿਖਣਾ ਪਸੰਦ ਵਿੱਚ ਮੈਂ ਜਦ ਵੀ ਕੋਈ ਚੀਜ਼ ਯਾਦ ਕਰਦੀ ਹਾਂ ਤਾਂ ਮੈਂ ਉਸ ਨੂੰ ਹਮੇਸ਼ਾ ਲਿਖ ਕੇ ਉਸ ਦਾ ਅਭਿਆਸ ਕਰਦੀ ਹਾਂ ਤਾਂ ਕਿ ਉਹ ਚੀਜ਼ ਮੈਨੂੰ ਹਮੇਸ਼ਾ ਲਈ ਯਾਦ ਰਹਿ ਸਕੇ ਮੈਂ ਅੱਜ ਤੱਕ ਆਪਣਾ ਅਜੇ ਕੁਛ ਇੰਨਾ ਜ਼ਿਆਦਾ ਲਿਖਿਆ ਨਹੀਂ ਹੈ ਕੋਈ ਪਰਟੀਕੁਲਰ ਪੁਸਤਕ ਬਾਰੇ ਮੈਂ ਨਹੀਂ ਲਿਖਿਆ ਮੈਂ ਜੋ ਚੀਜ਼ ਆਪਣੀ ਪੜ੍ਹਦੀ ਹਾਂ ਜੇ ਮੈਨੂੰ ਉਸ ਵਿੱਚ ਕੋਈ ਗਲਤੀ ਲੱਗਦੀ ਹੈ ਤਾਂ ਮੈਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਹਾਂ ਮੈਨੂੰ ਪੰਜਾਬੀ ਵਿੱਚ ਲਿਖਣਾ ਬਹੁਤ ਜ਼ਿਆਦਾ ਪਸੰਦ ਹੈ ਜੇਕਰ ਮੈਨੂੰ ਕੱਲ੍ਹ ਨੂੰ ਮੌਕਾ ਮਿਲਿਆ ਤਾਂ ਮੈਂ ਪੰਜਾਬੀ ਵਿੱਚ ਜ਼ਰੂਰ ਕੁਝ ਨਾ ਕੁਝ ਲਿਖਾਂਗੀ ਅਤੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਵਾਂਗੀ ਹਾਲੇ ਮੈਂ ਜੋ ਆਪਣਾ ਪੜ੍ਹਦੀ ਹਾਂ ਮੈਂ ਉਸ ਵਿੱਚ ਜੇਕਰ ਕੋਈ ਗਲਤੀ ਲੱਗਦੀ ਹੈ ਤਾਂ ਉਸਨੂੰ ਸੁਧਾਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਉਹ ਚੀਜ਼ ਮੇਰੀ ਚੰਗੀ ਤੋਂ ਚੰਗੀ ਤਰ੍ਹਾਂ ਸੋਹਣੀ ਹੋ ਜਾਵੇ ਤਾਂ ਉਸ ਵਿੱਚ ਕੋਈ ਵੀ ਗਲਤੀ ਨਾ ਰਹੇ ਇਸ ਲਈ ਮੈਂ ਅੱਜ ਵ ਤੱਕ ਆਪਣੇ ਕੁਝ ਕਿਤਾਬਾਂ ਵਿੱਚ ਕਾਫ਼ੀ ਜ਼ਿਆਦਾ ਸੁਧਾਰ ਕਰ ਚੁੱਕੀ ਹਾਂ ਲਿਖਣ ਦੇ ਨਾਲ ਨਾਲ ਹੀ ਮੈਨੂੰ ਪੜ੍ਹਨਾ ਵੀ ਬਹੁਤ ਜ਼ਿਆਦਾ ਪਸੰਦ ਹੈ ਇਸ ਲਈ ਮੈਂ ਜਦ ਵੀ ਕੋਈ ਨ ਕੋਈ ਕਹਾਣੀ ਵਗੈਰਾ ਪੜ੍ਹਦੀ ਹਾਂ ਐਕਸਟਰਾ ਕੁਛ ਚੀਜ਼ ਪੜਦੀ ਹਾਂ ਤਾਂ ਮੈਂ ਉਸ ਵਿੱਚੋਂ ਕੁਛ ਚੀਜ਼ਾਂ ਵਖਰੀਆਂ ਕੱਢ ਕੇ ਉਸ ਦੇ ਮਤਲਬ ਲਿਖ ਰ ਕੇ ਰੱਖ ਲੈਂਦੀ ਹਾਂ ਕਿਉਂਕਿ ਵੱਖਰਿਆ ਕੱਢੀਆਂ ਹੋਈਆਂ ਚੀਜ਼ਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਹਨ ਅਤੇ ਇਸ ਨੂੰ ਯਾਦ ਰੱਖਣ ਲਈ ਹੀ ਮੈਂ ਉਸਨੂੰ ਵੱਖਰਾ ਕਰਕੇ ਲਿਖ ਲੈਂਦੀ ਹਾਂ ਧੰਨਵਾਦ